ਮੈਂ ਤੁਹਾਨੂੰ ਪੰਜਾਬ ਦੀ ਕਾਨੂੰਨੀ ਪ੍ਰਣਾਲੀ ਦੇ ਵਿੱਚ ਕਾਨੂੰਨੀ ਪੇਸ਼ਾਵਰ ਪੇਸ਼ਾਵਰਾਂ ਜਿਵੇਂ ਕਿ ਅਟੋਰਨੀ ਜੱਜਾਂ ਦੀ ਭੂਮਿਕਾ ਬਾਰੇ ਦੱਸਣਾ ਚਾਹਾਂਗੀ ਪੰਜਾਬ ਦੀ ਕਾਨੂੰਨੀ ਪ੍ਰਣਾਲੀ ਬਹੁਤ ਵਿਸ਼ਾਲ ਅਤੇ ਗੁੰਝਲਦਾਰ ਹੈ ਜਿਸ ਵਿੱਚ ਵੱਖ ਵੱਖ ਕਾਨੂੰਨ ਪੇਸ਼ਾਵਰਾਂ ਦੀਆਂ ਮੁੱਖ ਭੂ ਭੂਮਿਕਾਵਾਂ ਹਨ ਸਭ ਤੋਂ ਪਹਿਲਾਂ ਅਸੀਂ ਅਦਾਲਤੀ ਅਧਿਕਾਰੀਆਂ ਬਾਰੇ ਗੱਲ ਕਰਦੇ ਹਾਂ ਅਦਾਲਤੀ ਅਧਿਕਾਰੀ ਜਿਵੇਂ ਕਿ ਜੱਜ ਅਤੇ ਮੈਜਿਸਟਰੇਟ ਅਦਾਲਤ ਵਿੱਚ ਨਿਆਂ ਦੀ ਤਰੀਕਿਆਂ ਨੂੰ ਚਲਾਉਂਦੇ ਹਨ ਉਹ ਮਾਮਲਿਆਂ ਦੀ ਸੁਣਵਾਈ ਕਰਦੇ ਹਨ ਸਬੂਤਾਂ ਨੂੰ ਸੁਣਦੇ ਹਨ ਅਤੇ ਕਾਨੂੰਨ ਦੇ ਅਧਾਰ 'ਤੇ ਫੈਸਲੇ ਦਿੰਦੇ ਹਨ ਜੱਜ ਦਾ ਕੰਮ ਬਹੁਤ ਜ਼ਿੰਮੇਵਾਰ ਅਤੇ ਨਿਆਂ ਪ੍ਰੇਮੀ ਹੁੰਦਾ ਹੈ ਕਿਉਂਕਿ ਉਹ ਲੋਕਾਂ ਨੂੰ ਨਿਆਂ ਦਿੰਦੇ ਹਨ ਹਰ ਇੱਕ ਬੰਦੇ ਦੀ ਉਮੀਦ ਜੋ ਬੰਦਾ ਕੇਸ ਕਰਦਾ ਹੈ ਉਸਦੀ ਉਮੀਦ ਜੱਜ ਦੇ ਉੱਤੇ ਟਿਕੀ ਹੁੰਦੀ ਹੈ ਕਿ ਉਹ ਉਸ ਨਾਲ ਇਨਸਾਫ ਹੀ ਕਰੇਗਾ ਮਾ ਜਿਵੇਂ ਕੇਸ ਜਿਵੇਂ ਕਿ ਮਾਡਰ ਰੇਪ ਆਦਿ ਦੇ ਹੁੰਦੇ ਹਨ ਠੀਕ ਹੈ ਜੱਜ ਨੂੰ ਕੋਈ ਵੀ ਫੈਸਲਾ ਲੈਣਾ ਜੱਜ ਵਾਸਤੇ ਸੌਖਾ ਨਹੀਂ ਹੁੰਦਾ ਸਪੈਸ਼ਲੀ ਉਹਨਾਂ ਕੇਸਾਂ ਦੇ ਵਿੱਚ ਜਦੋਂ ਜੱਜ ਨੇ ਕਿਸੇ ਨੂੰ ਫਾਂਸੀ ਦੀ ਸਜ਼ਾ ਦੇਣੀ ਹੁੰਦੀ ਹੈ ਇਹ ਕੰਮ ਕਰਨਾ ਜੱਜ ਵਾਸਤੇ ਵੀ ਔਖਾ ਹੁੰਦਾ ਹੈ ਦੂਜਾ ਅਸੀਂ ਵਕੀਲਾਂ ਦੀ ਗੱਲ ਕਰਦੇ ਹਾਂ ਵਕੀਲ ਮੁੱਖ ਤੌਰ 'ਤੇ ਮੁਕੱਦਮਿਆਂ ਵਿੱਚ ਪਾਸਿਆਂ ਦੀ ਵਕਾਲਤ ਕਰਦੇ ਹਨ ਉਹ ਮਾਮਲਿਆਂ ਦੀ ਤਿਆਰੀ ਕਰਦੇ ਹਨ ਸਬੂਤਾਂ ਨੂੰ ਪੇਸ਼ ਕਰਦੇ ਹਨ ਅਤੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਅਦਾਲਤ ਵਿੱਚ ਦਲੀਲਾਂ ਦਿੰਦੇ ਹਨ ਵਕੀਲਾਂ ਦੀਆਂ ਵੀ ਵੱਖ ਵੱਖ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਕ੍ਰਿਮੀਨਲ ਲੋਇਰ ਸਿਵਲ ਲੋਇਰ ਪਰਿਵਾਰਿਕ ਮਾਮਲਿਆਂ ਦੇ ਵਕੀਲ ਆਦਿ ਕ੍ਰਿਮੀਨਲ ਲੋਇਰ ਉਹਨਾਂ ਲੋਕਾਂ ਦੀ ਪੇਸ਼ਕਸ਼ ਕਰਦੇ ਹਨ ਜਿਹਨਾਂ 'ਤੇ ਜ਼ੁਰਮ ਦਾ ਇਲਜ਼ਾਮ ਹੁੰਦਾ ਹੈ ਜਦ ਕਿ ਸਿਵਲ ਲੋਇਰ ਜਾਇਦਾਦ ਵਿਵਹਾਰ ਅਤੇ ਅਨਿਆਂ ਨਾਗਰਿਕ ਮਸ ਮਾਮਲਿਆਂ ਵਿੱਚ ਸਹਾਇਕ ਹੁੰਦੇ ਹਨ ਅੱਗੇ ਅਸੀਂ ਪਰੋਸੀਕਿਊਟਰਾਂ ਦੀ ਗੱਲ ਕਰਦੇ ਹਾਂ ਪਰੋਸੀਕਿਊਟਰ ਸਰਕਾਰ ਦੇ ਵਕੀਲ ਹੁੰਦੇ ਹਨ ਜੋ ਅਪਰਾਧੀ ਮਾਮਲਿਆਂ ਵਿਚ ਦੋਸ਼ ਲਾਉਣ ਵਾਲੇ ਪਾਸੇ ਦੀ ਵਕਾਲਤ ਕਰਦੇ ਹਨ ਉਹ ਅਧਿਕਾਰੀਆਂ ਨੂੰ ਸਜ਼ਾ ਦਵਾਉਣ ਲਈ ਸਬੂਤਾਂ ਅਤੇ ਗਵਾਹਾਂ ਨੂੰ ਪੇਸ਼ ਕਰਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਕਿ ਕਾਨੂੰਨ ਦੀ ਭਾਵੇਂ ਮ ਪਾਲਣਾ ਹੋਵੇ ਪਰੋਸੀਕਿਊਟਰਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਉਹ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ ਅਤੇ ਅਪਰਾਧੀਆਂ ਨੂੰ ਸਜ਼ਾ ਦਵਾਉਂਦੇ ਹਨ ਉਹ ਕੇਸ ਦੀ ਪੂਰੀ ਪੁੱਛ ਗਿਛ ਕਰਦੇ ਹਨ ਕਿ ਕਿਵੇਂ ਇਹ ਜ਼ੁਰਮ ਹੋਇਆ ਉਹ ਪੂਰੀ ਇਨਵੈਸਟੀਗੇਸ਼ਨ ਕਰਦੇ ਹਨ ਇਸ ਤੋਂ ਇਲਾਵਾ ਅਸੀਂ ਨੋਟਰੀ ਪਬਲਿਕ ਦੀ ਗੱਲ ਕਰਦੇ ਹਾਂ ਨੋਟਰੀ ਪਬਲਿਕ ਵੱਖ ਵੱਖ ਕਾਨੂੰਨੀ ਦਸਤਾਵੇਜ਼ਾਂ ਨੂੰ ਮਾਨਤਾ ਦਿੰਦੇ ਹਨ ਅਤੇ ਸਹੀ ਜਾਂ ਸਹੀ ਕਾਪੀਆਂ ਬਣਾਉਂਦੇ ਹਨ ਉਹ ਕਾਨੂੰਨੀ ਪ੍ਰਣਾਲੀ ਵਿੱਚ ਬਹੁਤ ਹੀ ਜ਼ਰੂਰੀ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਉਹ ਦਸਤਾਵੇਜ਼ਾਂ ਦੀ ਮੋਹਰਿਆਂ ਨੂੰ ਨਿਆਇਕ ਤੌਰ 'ਤੇ ਪੱਕਾ ਕਰਦੇ ਹਨ ਇਹ ਸਾਰੇ ਕਾਨੂੰਨੀ ਪੇਸ਼ਾਵਰ ਪੰਜਾਬ ਦੇ ਕਾਨੂੰਨੀ ਪ੍ਰਣਾਲੀ ਦੇ ਮਹੱਤਵਪੂਰਨ ਹਿੱਸੇ ਹਨ ਅਤੇ ਉਹਨਾਂ ਦੀਆਂ ਆਪਣੀਆਂ ਮੁੱਖ ਜ਼ਿੰਮੇਵਾਰੀਆਂ ਹਨ